ਮੈਂ ਫਲਿਪਕਾਰਟ ਤੋਂ ਸ਼ੋਪਿੰਗ ਕਰਦਾ ਹਾਂ ਅਤੇ ਮੈਂ ਸ਼ੋਪਿੰਗ ਕਰਦੇ ਟਾਇਮ ਦੂਜੀ ਵਾਰ ਇੱਕ ਜੈਕੇਟ ਔਡਰ ਕੀਤੀ ਸੀ ਜਿਸ ਵਿੱਚ ਮੈਨੂੰ ਬਹੁਤ ਹੀ ਵਧੀਆ ਔਫਰ ਮਿਲਿਆ ਸੀ ਮੈਂ ਉਸ ਜੈਕੇਟ ਨੂੰ ਜਦੋਂ ਦੇਖਿਆ ਜਾ ਕੇ ਪਹਿਲੀ ਉਹ ਜੈਕੇਟ ਮੈਨੂੰ ਬਹੁਤ ਸੋਹਣੀ ਲੱਗੀ ਅਤੇ ਉਸਦਾ ਸਾਈਜ਼ ਵੀ ਮੇਰੇ ਨਾਪ ਦਾ ਹੀ ਸੀਗਾ ਪਰ ਉਸਨੂੰ ਮੰਗਵਾਉਣਾ ਮੇਰੇ ਵੀ ਮੇਰੇ ਲਈ ਸਭ ਤੋਂ ਗੰਦਾ ਡਸੀਜ਼ਨ ਸੀਗਾ ਕਿਉਂਕਿ ਇੱਕ ਤਾਂ ਉਹ ਜਦ ਮੇਰ ਮੇਰੇ ਮੈਨੂੰ ਦਿੱਤੇ ਸਮਾਂ ਤੋਂ ਛੇ ਦਿਨ ਬਾਅਦ ਮੇਰੇ ਕੋਲ ਆਈ ਅਤੇ ਜਦੋਂ ਮੈਂ ਉਸਨੂੰ ਪੈਕੇਟ 'ਚ ਖੋਲ੍ਹਿਆ ਅਤੇ ਕੱਢ ਕੇ ਬਾਹਰ ਦੇਖਿਆ ਤਾਂ ਦੇਖਿਆ ਪਹਿਲੀ ਤਾਂ ਉਹਦਾ ਕਲਰ ਹੀ ਚੇਂਜ ਸੀਗਾ ਅਤੇ ਲੈਦਰ ਦੀ ਕੁਆਲਿਟੀ ਇਕਦਮ ਬੇਕਾਰ ਸੀਗੀ ਉਹਦੀ ਜਿੱਪਾਂ ਵੀ ਟੁੱਟੀਆਂ ਹੋਈਆਂ ਸਨ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਅਤੇ ਮੈਂ ਰੀਫੰਡ ਵੀ ਪਾਇਆ ਫਲਿਪਕਾਰਟ ਵਿੱਚ ਅਤੇ ਉਹ ਵੀ ਮੈਨੂੰ ਮੇਰੇ ਪੈਸੇ ਵਾਪਸ ਨਹੀਂ ਮਿਲੇ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਕਿ ਮੈਂ ਇਸ ਜੈਕੇਟ ਨੂੰ ਔਡਰ ਕੀਤਾ ਅਤੇ ਮੇਰੇ ਪੈਸੇ ਮੈਨੂੰ ਵਾਪਸ ਨਹੀਂ ਮਿਲੇ